ਹੈਲੋ ਸਤਿ ਸ਼੍ਰੀ ਅਕਾਲ ਬਾਈ ਜੀ ਪਛਾਣ ਲਿਆ ਜੀ ਮੈਨੂੰ ਮੈਂ ਸੰਦੀਪ ਬੋਲਦਾ ਜੀ ਆਹ ਤੁਹਾਡੇ ਹੁਣ ਮੁਹੱਲੇ 'ਚ ਨਵਾਂ ਰਹਿਣ ਆਇਆ ਵੇਆਂ ਆਪਾਂ ਜੀ ਗੁਰਦੁਆਰਾ ਸਾਹਿਬ ਮਿਲੇ ਸੀ ਆਪਾਂ ਸਵੇਰੇ ਅੱਜ ਹਾਂ ਹਾਂਜੀ ਅਸੀਂ ਨਵੇਂ ਰਹਿਣ ਲੱਗੇ ਹਾਂ ਜੀ ਇੱਥੇ ਹਾਂਜੀ ਹਾਂ ਹਾਂਜੀ ਹਾਂਜੀ ਉੱਥੇ ਮੈਂ ਦੋ ਤਿੰਨ ਨਾਲ ਇੱਕ ਗੱਲ ਜਿਹੀ ਕੀਤੀ ਮੈਨੂੰ ਕਹਿੰਦੇ ਜੀ ਵੀ ਕਹਿੰਦੇ ਵੀ ਇਹ ਬਹੁਤ ਵਧੀਆ ਗੇ ਤਾਂ ਕਹਿੰਦੇ ਹੈਲਪਫੁਲ ਹੈ ਕਹਿੰਦੇ ਹਰ ਇੱਕ ਨਾਲ ਦੇ ਵੀਰ ਬਹੁਤ ਅੱਛਾ ਹੈਗਾ ਅਤੇ ਤੁਹਾਨੂੰ ਵਧੀਆ ਗਾਈਡ ਕਰਨਗੇ ਵੀ ਜੇਕਰ ਤੁਹਾਨੂੰ ਲੋੜ ਪੈਂਦੀ ਹੈ ਤਾਂ ਵੀ ਤੁਹਾਡੇ ਨਾਲ ਹੀ ਗੱਲ ਕਰਾਂ ਮੈਂ ਹਾਂਜੀ ਹਾਂ ਬਾਕੀ ਜਿਹੜੀ ਆਪਣੀ ਦੋ ਚਾਰ ਮਿੰਟ ਉੱਥੇ ਗੱਲ ਜਿਹੀ ਹੋਈ ਮੈਨੂੰ ਵਧੀਆ ਲੱਗਿਆ ਤੁਹਾਡਾ ਸੁਭਾਅ ਮੈਂ ਕਿਹਾ ਯਾਰ ਤੁਸੀਂ ਮੈਨੂੰ ਵਧੀਆ ਗਾਈਡ ਕਰੋਂਗੇ ਹਾਂਜੀ ਜੀ ਹਾਂਜੀ ਹਾਂਜੀ ਮੈਨੂੰ ਨਾ ਇੱਕ ਸਮੱਸਿਆ ਹੈਗੀ ਮੈਨੂੰ ਹਾਂਜੀ ਸਾਡੇ ਤਾਂ ਜਵਾਕ ਨਾ ਇੱਥੋਂ ਦੁੱਧ ਹੀ ਨਹੀਂ ਪੀਂਦੇ ਹੈ ਡੈਰੀ ਦਾ ਜਿਹੜੀ ਤੋਂ ਅਸੀਂ ਲੈਂਦੇ ਹੈਗੇ ਹਾਂ ਪਤਾ ਨਹੀਂ ਕੀ ਚੱਕਰ ਆ ਮੈਨੂੰ ਕੋਈ ਵਧੀਆ ਡੇਅਰੀ ਦੱਸੋ ਹੈ ਨਾ ਜਾਂ ਕਿਸੇ ਦੇ ਘਰ ਦੁੱਧ ਲਗਵਾ ਕੇ ਦਿਓ ਮੇਰਾ ਬਹੁਤ ਔਖਾ ਹੋਇਆ ਪਿਆ

ਅੱਛਾ ਜੀ ਅੱਛਾ ਅੱਛਾ ਅੱਛਾ ਜੀ ਅੱਛਾ ਅੱਛਾ ਅੱਛਾ ਅੱਛਾ ਵਧੀਆ ਫਰੈਸ਼ ਹੈਗਾ ਅੱਛਾ ਜੀ ਅੱਛਾ ਅੱਛਾ ਅੱਛਾ ਜੀ ਅੱਛਾ ਅੱਛਾ ਖੋਆ ਖੁਆ ਵਧੀਆ ਨਿਕਲਦਾ ਦੁੱਧ ਦਾ ਹੈਂ ਅੱਛਾ ਅੱਛਾ ਅੱਛਾ ਸਾਡਾ ਪੰਜ ਕੁ ਹੁੰਦਾ ਕਿਲੋ ਜੀ ਲਾਗੇ ਹੁੰਦਾ ਸਾਡੇ ਪੰਜ ਕਿਲੋ ਹਾਂ ਬਚ ਬੱਚਿਆਂ ਕਰਕੇ ਨਾ ਲੱਗਦਾ ਹੈਗਾ ਹਾਂਜੀ ਹਾਂਜੀ ਬਸ ਬੱਚੇ ਫਿਰ ਦੁੱਧ 'ਚ ਪੱਤੀ ਅਤੇ ਆਪ ਵੀ ਅਤੇ ਐਂ ਵੀ ਆਏ ਗਏ ਦਾ ਘਰ ਆ ਦੁੱਧ ਦਾ ਬਹੁਤ ਜ਼ਿਆਦਾ ਲੱਗਦਾ ਹੈਗਾ ਦਹੀਂ ਦੇ ਸ਼ੌਕੀਨ ਆ ਬੱਚੇ ਪਨੀਰ ਵੀ ਭਾਲਦੇ ਵੀ ਘਰ ਦਾ ਬਣਾਉਂਦੇ ਐਗੇ ਫਿਰ ਚੱਲ ਰੈਡੀਮੇਟ ਪਨੀਰ ਵਧੀਆ ਨਹੀਂ ਹੁੰਦਾ ਹੈਗਾ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਅੱਛਾ ਅੱਛਾ ਠੀਕ ਹੈ ਤੁਸੀਂ ਤੁਸੀਂ ਉਹਨਾਂ ਦੀ ਯੂਜ ਕਰਦੇ ਹੋ ਸਾਰੀਆਂ ਚੀਜ਼ਾਂ ਹਾਂ ਹਾਂ ਇਹ ਤਾਂ ਹੈ ਜੀ ਅੱਛਾ ਅਤੇ ਦੇਸੀ ਘਿਓ ਵਗੈਰਾ ਵੀ ਬਣਾਉਂਦੇ ਅੱਛਾ

ਹਾਂ ਹਾਂ ਉਹ ਤਾਂ ਹੈ ਚਲੋ ਰੇਟ ਦਾ ਤਾਂ ਐਂ ਕੋਈ ਗੱਲ ਨਹੀਂ ਹਾਂਜੀ ਅੱਛਾ ਅੱਛਾ ਵੀ ਚਲ ਐਵੇਂ ਚੀਜ਼ ਵਧੀਆ ਮਿਲਜੇ ਆਪਾਂ ਨੂੰ ਰੇਟ ਦਾ ਤਾਂ ਕੋਈ ਗ ਰੇਟ ਤਾਂ ਉੱਧਰ ਵੀ ਦੇਈ ਜਾਂਦੇ ਹਾਂ ਜੀ ਹਾਂਜੀ ਹਾਂਜੀ ਹਾਂਜੀ ਬਸ ਆ ਫਿਰ ਮਾੜਾ ਜਿਵੇਂ ਸਾਨੂੰ ਦਿੰਦੇ ਹੋ ਚੀਜ਼ ਵੀ ਵਧੀਆ ਹੀ ਦਿਓ ਜੀ ਹੈ ਨਾ ਹਾਂਜੀ ਹਾਂ ਇਹ ਨਾ ਨੰਬਰ ਸੇਵ ਕਰ ਲਿਓ ਜੀ ਤੁਸੀਂ ਹਾਂਜੀ ਅੱਛਾ ਅੱਛਾ ਧ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਬਹੁਤ ਹਾਂ ਹਾਂ ਹਾਂ ਹਾਂ ਠੀਕ ਹੈ ਬਾਈ ਜੀ ਹਮ ਹਮ ਓਕ ਓਕੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ